ਪੰਜਾਬ ਵਿੱਚ ਮੁੱਖ ਤੌਰ 'ਤੇ ਸਿੱਖ ਧਰਮ ਨੂੰ ਮੰਨਿਆਂ ਜਾਂ ਫੋਲੋ ਕੀਤਾ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਦਸ ਪਾਤਸ਼ਾਹੀਆਂ ਦੀ ਸਿੱਖਿਆ ਦਰਜ ਹੈ ਅਤੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਪੰਜਾਬ ਦੇ ਵਿੱਚ ਦਸ ਗੁਰੂਆਂ ਦੀ ਬਾਣੀ ਪੜ੍ਹੀ ਅਤੇ ਸਚਾਰ ਕੀਤੀ ਜਾਂਦੀ ਹੈ ਬਾਣੀ ਦੇ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਜਾਂਦਾ ਹੈ ਜਿਵੇਂ ਕਿ ਸਭ ਨਾਲ ਮਿਲ ਵਰਤ ਕੇ ਰਹਿਣਾ ਸਭ ਸਭ ਜਾਤ ਪਾਤ ਦੇ ਲੋਕਾਂ ਨੂੰ ਸਭ ਧਰਮਾਂ ਦੇ ਲੋਕਾਂ ਨੂੰ ਇੱਕ ਬਰਾਬਰ ਮੰਨਣਾ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਅਤੇ ਬਾਣੀ ਦੇ ਵਿੱਚ ਸਾਨੂੰ ਔਰਤ ਦੇ ਦਰਜੇ ਨੂੰ ਵੀ ਉੱਤੇ ਦੱਸਿਆ ਗਿਆ ਹੈ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਬਾਣੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਉਚਾਰ ਕੀਤਾ ਜਾਂਦਾ ਹੈ ਜਿਸ ਵਿੱਚ ਬਾਬਾ ਜੀ ਦੱਸਦੇ ਨੇ ਕਿ ਸਾਨੂੰ ਸਾਰਿਆਂ ਨੂੰ ਇੱਕ ਬਰਾਬਰ ਦਰਜਾ ਦੇਣਾ ਚਾਹੀਦਾ ਹੈ ਅਤੇ ਸਾਨੂੰ ਰਲ ਮਿਲ ਕੇ ਇਕੱਠੇ ਰਹਿਣਾ ਚਾਹੀਦਾ ਹੈ ਪੰਜਾਬ ਵਿੱਚ ਕੁਝ ਹਿੰਦੂ ਧਰਮ ਦੇ ਵੀ ਲੋਕ ਹਨ ਅਤੇ ਕੁਝ ਪ੍ਰਸੈਂਟ ਦੇ ਵਿੱਚ ਮੁਸਲਿਮ ਭਾਈ ਵੀ ਮਿਲਦੇ ਹਨ ਅਸੀਂ ਸਾਡੀ ਬਾਣੀ ਤੋਂ ਬਹੁਤ ਕੁਝ ਸਿੱਖਦੇ ਹਾਂ ਅਤੇ ਇਸ ਨੂੰ ਰੋਜ਼ ਉਪਯੋਗ ਕਰਦੇ ਹਾਂ ਸਾਡੀ ਬਾਣੀ ਦੱਸਦੀ ਹੈ ਕਿ ਅਸੀਂ ਇਮਾਨਦਾਰੀ ਨਾਲ ਸਭ ਕੰਮ ਕਰੀਏ ਸੱਚ ਬੋਲੀਏ ਅਤੇ ਜ਼ਰੂਰਤਮੰਦ ਦੀ ਮਦਦ ਕਰੀਏ ਅਤੇ ਸਭ ਨਾਲ ਮਿਲ ਵਰਤ ਕੇ ਪਿਆਰ ਨਾਲ ਰਹੀਏ